ਸਾਡੇ ਖੇਤਰ ਵਿੱਚ ਦੇਖੇ ਜਾਣ ਵਾਲੇ ਪੰਛੀ ਚਿੜੀਆਂ ਕਾਂ ਕਬੂਤਰ ਘਟਾਰਾਂ ਮੋਰ ਅਤੇ ਤੋਤੇ ਹਨ ਜ਼ਿਆਦਾਤਰ ਤਾਂ ਚਿੜੀਆਂ ਅਤੇ ਕਾਂ ਹੀ ਦੇਖਣ ਨੂੰ ਮਿਲਦੇ ਹਨ ਇਹ ਵੀ ਘਰਾਂ ਦੇ ਬਨੇਰਿਆਂ 'ਤੇ ਦਰੱਖਤਾਂ 'ਤੇ ਬੈਠੇ ਅਕਸਰ ਹੀ ਚੀ ਚੀ ਕਾਂ ਕਾਂ ਕਰਦੇ ਦਿਖ ਜਾਂਦੇ ਹਨ ਅਤੇ ਚਿੜੀਆਂ ਤੇ ਕਾਂ ਤਾਂ ਪਿੰਡਾਂ ਵਿੱਚ ਜਦੋਂ ਸਵੇਰ ਹੁੰਦੀ ਆ ਤਾਂ ਚਿੜੀਆਂ ਅਤੇ ਕਾਵਾਂ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਨੇ ਤਾਂ ਬਹੁਤ ਸੋਹਣਾ ਲੱਗਦਾ ਵੈਸੇ ਜੇ ਗੱਲ ਕਰੀ ਜਾਵੇ ਤਾਂ ਮੈਨੂੰ ਦੇਖਣ ਵਿੱਚ ਤਾਂ ਮੋਰ ਅਤੇ ਤੋਤਾ ਜ਼ਿਆਦਾ ਪਸੰਦੀਦਾ ਵਧੀਆ ਲੱਗਦੇ ਨੇ ਪੰਛੀ ਪਸੰਦੀਦਾ ਨੇ ਪਰ ਅੱਜ ਕੱਲ੍ਹ ਜੇ ਗੱਲ ਕਰੀ ਜਾਵੇ ਤਾਂ ਬਹੁਤ ਘੱਟ ਨਜ਼ਰ ਆਉਂਦੇ ਨੇ ਤੋਤਾ ਵੀ ਮੋਰ ਵੀ ਦਿਨ ਦੇ ਵਿੱਚ ਇੱਕ ਅੱਧੀ ਵਾਰ ਇੱਕ ਅੱਧੀ ਵਾਰ ਇਹ ਦੇਖਦੇ ਨੇ ਨਜ਼ਰ ਆਉਂਦੇ ਨੇ ਅਤੇ ਮੋਰ ਤਾਂ ਪਸੰਦੀਦਾ ਪੰਛੀ ਹੈ ਕਿਉਂਕਿ ਮੋਰ ਨੂੰ ਜਦੋਂ ਪੈਲ ਪਾਉਂਦਾ ਦੇਖਦੇ ਆ ਤਾਂ ਬਹੁਤ ਸੋਹਣਾ ਲੱਗਦਾ ਪੈਲ ਪਾਉਂਦਾ ਹੀ ਬਹੁਤ ਸੋਹਣੀ ਆ ਅਤੇ ਪੈਲ ਪਾਉਣ ਤੋਂ ਬਾਅਦ ਫਿਰ ਆਪਣੇ ਇਹ ਸੋਹਣੇ ਸੋਹਣੇ ਪੰਖ ਵੀ ਸਿੱਟ ਕੇ ਜਾਂਦਾ ਅਤੇ ਜਿਹੜੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹੁੰਦੇ ਜਦੋਂ ਆਪਾਂ ਹੱਥ 'ਚ ਫੜਦੇ ਉਦੋਂ ਤਾਂ ਹੋਰ ਵੀ ਸੋਹਣੇ ਲੱਗਦੇ ਨੇ ਅਤੇ ਇਸ ਕਰਕੇ ਫਿਰ ਮੋਰ ਸਭ ਤੋਂ ਵੱਧ ਪਸੰਦੀਦਾ ਪੰਛੀ ਹੈ ਮੇਰਾ ਤਾਂ ਤੋਤੇ ਵੀ ਪਸੰਦੀਦਾ ਨੇ ਤੋਤਾ ਉਝ ਤੋਤਿਆਂ ਦਾ ਕਲਰ ਏ ਬਹੁਤ ਸੋਹਣਾ ਹੁੰਦਾ ਹਰੇ ਰੰਗ ਦੇ ਅਤੇ ਜਦੋਂ ਉੜ ਕੇ ਉਹ ਵੀ ਆਪਣੀ ਆਵਾਜ਼ ਕੱਢਦੇ ਨੇ ਉਹ ਵੀ ਬਹੁਤ ਸੋਹਣੇ ਲੱਗਦੇ ਨੇ